ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਵਧੀਆ ਜੀ ਤੁਸੀਂ ਕੌਣ ਅੱਛਾ ਅੱਛਾ ਜੀ ਨਾਲ ਦੇ ਹੈ ਜਿਹੜੇ ਨੇਬਰ ਠੀਕ ਆ ਜੀ ਕੀ ਹਾਲ ਤੁਹਾਡਾ ਕੀ ਹਾਲ ਹੈ ਜੀ ਬਸ ਵਧੀਆ ਜੀ ਹਾਂਜੀ ਜੀ ਹੋ ਗਈ ਲਗਭਗ ਵਧੀਆ ਰਹੀ ਹਾਂਜੀ ਹਾਂਜੀ ਹਾਂਜੀ ਸਭ ਵਧੀਆ ਤੁਸੀਂ ਦੱਸੋ ਕਿਸ ਤਰ੍ਹਾਂ ਦੀ ਹੈ ਏਰੀਆ ਕਿਸ ਤਰ੍ਹਾਂ ਦਾ ਹੈ ਦੱਸੋਂਗੇ ਕੁਛ ਇੱਧਰ ਨਵੇਂ ਨਵੇਂ ਸ਼ਿਫਟ ਹੋਏ ਹਾਂ ਕੁਛ ਪਤਾ ਨਹੀਂ ਇੱਥੋਂ ਦਾ ਹਾਂਜੀ ਉਹ ਤਾਂ ਹੈ ਹਾਂਜੀ ਹਾਂਜੀ ਮੈਂ ਤੁਹਾਨੂੰ ਇਹ ਪੁੱਛਣਾ ਸੀ ਜੀ ਕਿ ਤੁਸੀਂ ਮੈਂ ਥੋੜ੍ਹੀ ਸ਼ੋਪਿੰਗ ਕਰਨੀ ਸੀ ਸੂਟ ਸਵੈਟਰ ਵਗੈਰਾ ਲੈਣੇ ਸੀ ਤੁਸੀਂ ਦੱਸ ਸਕਦੇ ਹੋ ਕਿੱਥੋਂ ਵਧੀਆ ਮਿਲਦੇ ਨੇ ਹਾਂਜੀ ਸਵੈਟਰ ਲੈਣੇ ਸੀ ਜੀ ਵਧੀਆ 'ਚ ਹੀ ਲੈਣੇ ਹੈ ਜੀ ਵਧੀਆ ਅੱਛਾ ਜੀ ਵੈਸੇ ਮੈਂ ਉੱਥੇ ਗਈ ਸੀ ਹਾਂਜੀ ਮੈਂ ਬਾਰਗਨਿੰਗ ਕਰਨੀ ਮੈਨੂੰ ਬਹੁਤ ਔਖੀ ਲੱਗਦੀ ਹੈ ਜੀ ਹਾਂਜੀ ਇਹ ਮੁਸ਼ਕਿਲ ਹੋ ਜਾਂਦਾ ਕੰਮ ਠੀਕ ਹੈ ਜੀ ਵੈਸੇ ਤੁਸੀਂ ਕਿੱਥੋਂ ਲੈਂਦੇ ਹੋ ਜ਼ਿਆਦਾ ਠੀਕ ਆ ਜੀ ਹਾਂਜੀ ਹਾਂਜੀ ਠੀਕ ਆ ਜੀ ਹਮ ਅਤੇ ਬ੍ਰੈਂਡਿਡ ਕੱਪ ਕਿੱਥੋਂ ਮਿਲਣਗੇ ਜੇ ਬ੍ਰੈਂਡਿਡ ਲੈਣੇ ਹੋਣ ਅਤੇ ਅੱਛਾ ਜੀ ਤੁਸੀਂ ਜਾ ਸਕਦੇ ਹੋ ਮੇਰੇ ਨਾਲ ਚਲੋ ਠੀਕ ਆ ਤੁਸੀਂ ਮੈਨੂੰ ਟਾਈਮਿੰਗ ਦੱਸ ਦਿਓ ਹਾਂਜੀ ਜਦੋਂ ਤੁਸੀਂ ਫਰੀ ਹੋਵੋ ਅ ਹਾਂਜੀ ਤੁਸੀਂ ਮੈਨੂੰ ਦੱਸ ਦਿਓ ਟਾਈਮਿੰਗ ਫਿਰ ਉਸ ਦੇ ਅਕੋਰਡਿੰਗ ਅਸੀਂ ਨਾ ਚੱਲ ਜਾਵਾਂਗੇ ਹਾਂਜੀ ਜੀ ਓਕੇ ਜੀ ਹਾਂਜੀ ਥੈਂਕ ਯੂ ਬਾਏ